ਹੈਲੋ ਹਾਂ ਦੀ ਨਮਸਤੇ ਤੁਸੀਂ ਮਮਤਾ ਦੀਦੀ ਬੋਲਦੇ ਹੋ ਮੈਂ ਦੀ ਸੀਤਲ ਬੋਲਦੀ ਹਾਂ ਦੀਦੀ ਮੈਂ ਸੁਣਿਆ ਕਿ ਤੁਹਾਡੇ ਕੋਲ ਤੁਸੀਂ ਫੁੱਲਾਂ ਦੀ ਦੁਕਾਨ ਪਾਈ ਆ ਤੁਹਾਡੇ ਕੋਲ ਫੁੱਲ ਬਹੁਤ ਸੋਹਣੇ ਸੋਹਣੇ ਹੈਗੇ ਨੇ

ਹਾਂਜੀ ਦੀਦੀ ਇਹ ਵਾਲੇ ਜਿਹੜੇ ਤੁਸੀਂ ਫੁੱਲ ਦਾ ਫੁੱਲਾਂ ਦੇ ਨਾਮ ਦੱਸਿਆ ਨਾ ਤਾਂ ਤੁਸੀਂ ਇਹ ਵਾਲੇ ਫੁੱਲ ਨਾ ਮੈਨੂੰ ਭੇਜਿਓ ਤਾਂ ਮੈਂ ਮੈਨੂੰ ਫੁੱਲ ਬਹੁਤ ਪਸੰਦ ਨੇ ਹਾਂਜੀ ਦੀਦੀ ਅਤੇ ਨਾਲੇ ਨਾ ਮੈਨੂੰ ਇਹ ਵਾਲੇ ਫੁੱਲ ਵੀ ਭੇਜਿਓ ਅਤੇ ਨਾਲੇ ਮੈਨੂੰ ਥੋੜ੍ਹੇ ਜਿਹੇ ਨਾ ਬੂਟੇ ਵੀ ਭੇਜ ਦਿਓ ਅਤੇ ਤੁਸੀਂ ਨਾ ਤਾਂ ਨਾਲੇ ਰੇਟ ਦੱਸ ਦਿਓ ਹਾਂਜੀ ਹਾਂਜੀ ਦੀਦੀ ਠੀਕ ਹੈ ਹਾਂਜੀ ਦੀਦੀ ਠੀਕ ਹੈ ਦੀਦੀ ਓਕੇ